ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਇਹ ਮੀਡੀਆ ਨੂੰ ਅਲੱਗ ਅਲੱਗ ਤਰੀਕਿਆਂ ਨਾਲ਼ ਦਰਸਾਇਆ ਜਾਂਦਾ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਦੀ ਵਰਤੋਂ ਮੀਡੀਆ ਰੇਡੀਓ ਟੈਲੀਵਿਜ਼ਨ 'ਤੇ ਪਿੰਡ ਦੇ ਥਰੂ ਕੀਤੀ ਜਾਂਦੀ ਹੈ ਰੇਡੀਓ ਪੁਰਾਣੇ ਸਮਿਆਂ ਵਿੱਚ ਲੋਕ ਵਰਤਦੇ ਸੀ ਖਬਰਾਂ ਸੁਣਨ ਦੇ ਲਈ ਗਾਣੇ ਸੁਣਨ ਦੇ ਲਈ ਅੱਗੇ ਅੱਗੇ ਜਿਉਂ ਜਿਉਂ ਟਾਈਮ ਬਦਲਦਾ ਗਿਆ ਆਧੁਨਿਕ ਯੁੱਗ ਆਉਂਦਾ ਗਿਆ ਅਤੇ ਟੈਲੀਵਿਜ਼ਨ ਦਾ ਅਵਿਸ਼ਕਾਰ ਹੋਇਆ ਟੈਲੀਵਿਜ਼ਨ ਦੇ ਵਿੱਚ ਬਹੁਤ ਹੀ ਸੌਖਾ ਹੋ ਗਿਆ ਹੈ ਪੰਜਾਬੀ ਭਾਸ਼ਾ ਨੂੰ ਸੁਣਨਾ ਦੇਖਣਾ ਇਸ ਲੋਕ ਇਸ ਦੀ ਵਰਤੋਂ ਪੰਜਾਬੀ ਭਾਸ਼ਾ ਵਿੱਚ ਸੁਣ ਗਾਣੇ ਸੁਣਦੇ ਨੇ ਫਿਲਮਾਂ ਫਿਲਮਾਂ ਦੇਖਣ ਲਈ ਵਰਤਿਆ ਜਾਂਦਾ ਹੈ ਖਬਰਾਂ ਦੇਖਣ ਲਈ ਵਰਤਿਆ ਜਾਂਦਾ ਹੈ ਟੈਲੀਵਿਜ਼ਨ ਇਹੀ ਬਹੁਤ ਹੀ ਸੌਖਾ ਹੋ ਗਿਆ ਹੈ ਲੋਕਾਂ ਨੂੰ ਟੈਲੀਵਿਜ਼ਨ ਦੇ ਥਰੂ ਪੰਜਾਬੀ ਭਾਸ਼ਾ ਨੂੰ ਸਮਝਣਾ ਅਤੇ ਪ੍ਰਿੰਟਰ ਦੀ ਵਰਤੋਂ ਸਰਕਾਰੀ ਦਫ਼ਤਰਾਂ ਵਿੱਚ ਪ੍ਰਾਈਵੇਟ ਦਫਤਰਾਂ ਵਿੱਚ ਪੇਜਾਂ ਪੇਜਾਂ 'ਤੇ ਆਸਾਨੀ ਨਾਲ਼ ਪ੍ਰਿੰਟ ਹੋ ਜਾਂਦਾ ਹੈ ਪ੍ਰਿੰਟ ਦੇ ਥਰੂ ਤਾਂ ਜੋ ਉਸਨੂੰ ਆਸਾਨੀ ਨਾਲ਼ ਪੜ੍ਹਿਆ ਜਾ ਸਕੇ ਮੁਫਤ ਖਬਰਾਂ ਮੀਡੀਆ ਵਿੱਚ ਖਬਰਾਂ ਨੂੰ ਸੁਣ ਸੁਣਾਉਣ ਦੇ ਲਈ ਪਹਿਲਾਂ ਪ੍ਰਿੰਟ ਕੀਤਾ ਜਾਂਦਾ ਹੈ ਪੰਜਾਬੀ ਭਾਸ਼ਾ ਨੂੰ ਪੇਜਾਂ 'ਤੇ ਖਬਰਾਂ ਨੂੰ ਉਸ ਤੋਂ ਬਾਅਦ ਆਸਾਨੀ ਨਾਲ਼ ਤਾਂ ਜੋ ਉਹ ਖਬਰਾਂ ਨੂੰ ਬੋਲਿਆ ਜਾ ਸਕੇ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾ ਸਕੇ